ਅੱਜ ਕੱਲ੍ਹ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਹਨ ਜੋ ਕਿ ਬਹੁਤ ਹੀ ਫ਼ਾਇਦੇਮੰਦ ਸਾਬਤ ਹੋਈਆਂ ਹਨ ਜਿਸ ਨਾਲ ਬੜੀ ਹੀ ਤੇਜ਼ੀ ਨਾਲ ਕੰਮ ਹੋ ਜਾਂਦਾ ਹੈ ਜੋ ਕਿ ਇਨਸਾਨ ਉਹ ਇੰਨੀ ਤੇਜ਼ੀ ਨਾਲ ਕੰਮ ਨਹੀਂ ਕਰ ਪਾਉਂਦਾ ਬਿਜਲੀ ਨਾਲ ਚੱਲਣ ਨਾਲ ਬਹੁਤ ਹੀ ਅੱਧੇ ਟਾਈਮ ਵਿੱਚ ਅੱਧੇ ਟਾਈਮ ਵਿੱਚ ਕੰਮ ਹੋ ਜਾਂਦਾ ਹੈ ਜਿੱਦਾਂ ਕਿ ਇੱਕ ਸੂਟ ਨੂੰ ਕੋਈ ਔਖਾ ਸੂਟ ਬਣਾਉਣ ਲਈ ਪਲਾਜੋ ਸੂਟ ਜਾਂ ਪੈਂਟ ਸੂਟ ਬਣਾਉਣ ਵਾਸਤੇ ਪੂਰਾ ਦਿਨ ਲੱਗ ਜਾਂਦਾ ਸੀ ਉਹ ਹੀ ਅੱਜ ਕੱਲ੍ਹ ਇਲੈਕਟਰੋਨਿਕ ਮਸ਼ੀਨਾਂ ਦੇ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੇ ਨਾਲ ਅਸੀਂ ਬਹੁਤ ਹੀ ਜਲਦੀ ਅੱਧੇ ਟਾਈਮ ਵਿੱਚ ਅੱਧੇ ਦਿਨ ਵਿੱਚ ਹੀ ਉਹ ਸੂਟ ਪੂਰਾ ਕਰ ਸਕਦੇ ਹਾਂ ਕਿਉਂਕਿ ਐਨ ਇਹ ਹੀ ਬਹੁਤ ਹੈ ਮਸ਼ੀਨਾਂ ਬਹੁਤ ਹੀ ਤੇਜ਼ ਚੱਲਦੀਆਂ ਹਨ ਅਤੇ ਕੰਮ ਨੂੰ ਬੜੀ ਹੀ ਜਲਦੀ ਪੂਰਾ ਕਰਨ ਵਿੱਚ ਫ਼ਾਇਦੇਮੰਦ ਸਾਬਤ ਹੁੰਦੀਆਂ ਹਨ ਸਭ ਤੋਂ ਔਖਾ ਪਹਿਰਾਵਾ ਹੁੰਦਾ ਹੈ ਲਹਿੰਗਾ ਸੂਟ ਅਸੀਂ ਕਹਿ ਸਕਦੇ ਹਾਂ ਲਹਿੰਗਾ ਕਹਿ ਸਕਦੇ ਹਾਂ ਪਾਉਣ ਵਿੱਚ ਜਾਂ ਫਿਰ ਸਭ ਤੋਂ ਔਖਾ ਪਹਿਰਾਵਾ ਹੁੰਦਾ ਹੈ ਕਈਆਂ ਨੂੰ ਅਤੇ ਆਪਣਾ ਆਪਣਾ ਹਿਸਾਬ ਹੁੰਦਾ ਹੈ ਕਿਸੇ ਨੂੰ ਲਹਿੰਗਾ ਪਾਉਣਾ ਸਭ ਤੋਂ ਔਖਾ ਲੱਗਦਾ ਹੈ ਕਿਸੇ ਨੂੰ ਪੈਂਟ ਸੂਟ ਜਾਂ ਫਿਰ ਸ਼ਰਾਰਾ ਸੂਟ ਪਾਉਣਾ ਸਭ ਤੋਂ ਔਖਾ ਲੱਗਦਾ ਹੈ ਇਹਨਾਂ ਵਿੱਚ ਲਹਿੰਗਾ ਸੂਟ ਜਾਂ ਪੈਂਟ ਸੂਟ ਇਹਨਾਂ ਨੂੰ ਪਾਉਣ ਵਿੱਚ ਜਾਂ ਸਿਉਣ ਵਿੱਚ ਇਹਨਾਂ ਨੂੰ ਬਹੁਤ ਹੀ ਸਮਾਂ ਲੱਗ ਜਾਂਦਾ ਹੈ ਇਸ ਲਈ ਇਹਨਾਂ ਨੂੰ ਯੂਟੀਊਬ ਤੋਂ ਤਕਨੀਕਾਂ ਦੇਖ ਕੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ ਹੋਰ ਵੀ ਸੋਖੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਧੰਨਵਾਦ